ਪੱਚੀ ਜੁਲਾਈ ਉੱਨੀ ਸੌ ਨੱਬੇ ਤੇਈ ਦਸੰਬਰ ਅਠਾਰ੍ਹਾਂ ਸੌ ਪੰਜਾਹ ਪੱਚੀ ਦਸੰਬਰ ਉੱਨੀ ਸੌ ਸੱਠ ਇੱਕ ਜਨਵਰੀ ਦੋ ਹਜ਼ਾਰ ਸੌਲ੍ਹਾਂ ਇੱਕ ਦਸੰਬਰ ਦੋ ਹਜ਼ਾਰ ਪੰਜ